ਹੈਲੋ ਭਾਅ ਜੀ ਮੈਂ ਨਾ ਕੈਬ ਬੁੱਕ ਕੀਤੀ ਹੋਈ ਸੀ ਅਤੇ ਮੈਂ ਅੰਮ੍ਰਿਤਸਰ ਆਈ ਹੋਈ ਹਾਂ ਅਤੇ ਮੈਂ ਨਾ ਬੱਸ ਸਟੈਂਡ ਲਾਗੇ ਖੜ੍ਹੀ ਹਾਂ ਅਤੇ ਮੈਂ ਬੱਸ ਸਟੈਂਡ ਤੋਂ ਇੱਦਾਂ ਸ਼ਹੀਦਾਂ ਸਾਹਿਬ ਜਾਣਾ ਹੈਗਾ ਅਤੇ ਮੈਂ ਬੈ ਕੈਬ ਬੁੱਕ ਕੀਤੀ ਸੀ ਤੁਸੀਂ ਅਜੇ ਤੱਕ ਆਏ ਨਹੀਂ ਮੈਂ ਤੁਹਾਨੂੰ ਕਦੋਂ ਦੀ ਉਡੀਕ ਰਹੀ ਹਾਂ ਮੈਨੂੰ ਦਸ ਮਿਨਟ ਹੋ ਗਏ ਤੁਹਾਨੂੰ ਉਡੀਕਦੇ ਉਡੀਕਦੇ ਅਤੇ ਮੈਂ ਦੇਖੀ ਦੇਖੇ ਹੀ ਨਹੀਂ ਕਿ ਤੁਸੀਂ ਹਜੇ ਤੱਕ ਮੈਂ ਕਾਫੀ ਚਿਰ ਦੀ ਦੇਖ ਰਹੀ ਕਿ ਤੁਸੀਂ ਅਸੀਂ ਤੱਕ ਆਏ ਨਹੀਂ ਤੁਸੀਂ ਮੈਨੂੰ ਦੱਸ ਦਿਉ ਕਿ ਤੁਸੀਂ ਕਦੋਂ ਤੱਕ ਆਓਗੇ ਓਹ ਹੋ ਕੀ ਗੱਲ ਭਾਅ ਜੀ ਤੁਸੀਂ ਕਿੱਧਰ ਚਲੇ ਗਏ ਹੋ ਤੁਸੀਂ ਉਹ ਬੈਕ ਵਾਲੇ ਪਾਸੇ ਚਲੇ ਉਹ ਪਿੱਛੇ ਵਾਲੇ ਪਾਸੇ ਨਹੀਂ ਜਾਣਾ ਭਾਅ ਜੀ ਅੱਗੇ ਵਾਲੇ ਵ ਪਾਸੇ ਆਉਣਾ ਹੈ ਉਹ ਕੋਈ ਗੱਲ ਨਹੀਂ ਅੱਗੇ ਵਾਲੇ ਪਾਸੇ ਪਰਚੀ ਕੱਟ ਰਹੇ ਅਤੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਪੈਸੇ ਦੇਵਾਂਗੀ ਤੁਸੀਂ ਆਓ ਅਤੇ ਸਹੀ ਮੈਂ ਕਾਫੀ ਟਾਈਮ ਤੋਂ ਵੇਖੋ ਭਾਜੀ ਮੈਂ ਲੇਟ ਹੋ ਰਹੀ ਹੈ ਇੱਥੇ ਟਰੈਫਿਕ ਵੀ ਕਿੰਨੀ ਸਾਰੀ ਹੈਗੀ ਏ ਜਲਦੀ ਆ ਜਾਓ ਮੈਂ ਬਸ ਇੱਥੇ ਐਮ ਕੇ ਹੋਟਲ ਲਾਗੇ ਖੜ੍ਹੀ ਹਾਂ ਬਸ ਤੁਸੀਂ ਜਲਦੀ ਆ ਜਾਓ ਮੈਂ ਬਹੁਤ ਕਾਫੀ ਸੱਚੀ ਬਹੁਤ ਜ਼ਿਆਦਾ ਲੇਟ ਹੋ ਗਈ ਹਾਂ ਮੈਂ ਹੋਰ ਵੀ ਆਪਣੇ ਫਰੈਂਡਸ ਨਾਲ ਵੀ ਕਾਫੀ ਟਾਈਮ ਤੋਂ ਮਿਲਣ ਜਾਣਾਗਾ ਉਹ ਵੀ ਮੈਨੂੰ ਕੋਲ ਕਰ ਰਹੇ ਆ ਬਾਰ ਬਾਰ ਕਿ ਤੁਸੀਂ ਅਜੇ ਤੱਕ ਆਏ ਨੇ ਤੁਸੀਂ ਅਜੇ ਤੱਕ ਆਏ ਨਹੀਂ ਤੁਹਾਨੂੰ ਪਤਾ ਜਦੋਂ ਅੰਮ੍ਰਿਤਸਰ ਆਈਏ ਤਾਂ ਸਭ ਨੂੰ ਮਿਲਣਾ ਪੈਂਦਾ ਏ ਕਿ ਜਿੱਥੋਂ ਵੀ ਕੋਈ ਵੀ ਆਵੇ ਅਤੇ ਸਭ ਨੂੰ ਮਿਲਣ ਵੀ ਜਾਣਾ ਪੈਂਦਾ ਬਸ ਤੁਸੀਂ ਹੁਣ ਜਲਦੀ ਆ ਜਾਓ ਬਸ ਜੀ ਭਾਅ ਜੀ ਹਾਂ ਬਸ ਉਸੇ ਟਿਕਾਣੇ 'ਤੇ ਪਹੁੰਚ ਜਾਣਾ ਬੱਸ ਸਟੈਂਡ ਦੇ ਕੋਲ ਹੀ ਜਿਹੜਾ ਹੋਟਲ ਹੈਗਾ ਨਾ ਮੈਂ ਉੱਥੇ ਖੜ੍ਹੀ ਹਾਂ ਤੁਸੀਂ ਟਾਈਮ ਨਾਲ ਜਲਦੀ ਆ ਜਾਓ ਬਸ ਭਾਅ ਜੀ ਹਾਂਜੀ ਠੀਕ ਏ ਜੀ ਓਕੇ ਭਾਅ ਜੀ